ਹੈਲੋ ਮੈਂ ਇੱਕ ਐਮਾਜੌਨ ਤੋਂ ਇੱਕ ਬੈੱਡਸ਼ੀਟ ਮੰਗਵਾਈ ਸੀ ਜਦੋਂ ਮੈਂ ਉਹਨੂੰ ਔਡਰ ਕੀਤਾ ਤਾਂ ਉਹ ਦੇਖਣ 'ਚ ਉਹ ਬਹੁਤ ਵਧੀਆ ਲੱਗ ਰਹੀ ਸੀਗੀ ਉਹਦਾ ਪ੍ਰਿੰਟ ਐਂ ਲੱਗ ਰਿਹਾ ਸੀਗਾ ਵੀ ਬਹੁਤ ਜ਼ਿਆਦਾ ਅਟ੍ਰੈਕਟਿਵ ਹੈ ਅਤੇ ਉਹ ਦਾ ਕਲਰ ਵੀ ਬਹੁਤ ਵਧੀਆ ਲੱਗ ਰਿਹਾ ਸੀ ਜਦੋਂ ਮੈਂ ਉਹਨੂੰ ਔਡਰ ਨੂੰ ਔਡਰ ਨੂੰ ਪਲੇਸ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਔਡਰ ਹੈ ਪਹਿਲਾਂ ਤਾਂ ਉਹ ਡਿਲੀਵਰ ਏ ਮੈਨੂੰ ਬਹੁਤ ਲੇਟ ਹੋਇਆ ਮੈਂ ਫ਼ੋਨ ਕਰ ਕਰਕੇ ਮੈਸਿਜ ਈ ਮੇਲਜ਼ ਦੇਖ ਦੇਖ ਕੇ ਤਾਂ ਤਾਂ ਆਪਣੀ ਉਹ ਔਡਰ ਮੰਗਵਾਇਆ ਜਦੋਂ ਔਡਰ ਘਰ ਪਹੁੰਚਿਆ ਪਹਿਲਾਂ ਤਾਂ ਉਹਦੀ ਪੈਕਜਿੰਗ ਇੰਨੀ ਜ਼ਿਆਦਾ ਗੰਦੀ ਬਹੁਤ ਰੱਫ਼ ਪੇਪਰ 'ਚ ਉਹਨੂੰ ਪੈਕਜ ਪੈਕ ਕੀਤਾ ਹੋਇਆ ਸੀ ਅਤੇ ਜਦੋਂ ਮੈਂ ਉਹਨੂੰ ਖੋਲ੍ਹਿਆ ਤਾਂ ਉਹ ਕਟੀ ਫਟੀ ਆਈ ਉਹਦਾ ਪ੍ਰਿੰਟ ਉਹ ਬਿਲਕੁਲ ਜਿੱਦਾਂ ਦਾ ਮੈਂ ਔਡਰ ਕੀਤਾ ਉਹਦੇ ਨਾਲ਼ੋ ਬਿਲਕੁਲ ਓਪੋਜਿਟ ਉਹਨਾਂ ਨੇ ਭੇਜ ਦਿੱਤਾ ਜੋ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਮੈਂ ਉਹਦੇ ਮੈਂ ਉਹਨੂੰ ਨਾ ਤਾਂ ਮੈਂ ਉਹਨੂੰ ਵਾਪਿਸ ਕਰਨ ਜੋਗੀ ਨਾ ਮੈਂ ਉਹਨੂੰ ਰੱਖਣ ਜੋਗੀ ਕਿਉਂਕਿ ਉਹਦੇ 'ਚ ਰਿਟਰਨ ਪੋਲਿਸੀ ਵੀ ਨਹੀਂ ਸੀਗੀ ਕੀ ਤੁਸੀਂ ਰਿਟਰਨ ਕਰਲੋ ਜਾਂ ਐਕਸਚੇਂਜ ਕਰਲੋ ਕਹਿੰਦੇ ਕਿ ਇਸ ਪ੍ਰੋਡਕਟ 'ਤੇ ਤਾਂ ਜੀ ਰਿਟਰਨ ਪੋਲਿਸੀ ਨਹੀਂ ਹੈਗੀ ਅਤੇ ਮੇਰੇ ਲਈ ਉਹਨਾਂ ਨੇ ਜਿਹੜੀ ਫੀਡਬੈਕ ਸੀਗੀ ਉਹ ਵੀ ਜੀਰੋ ਸੀਗੀ ਅਤੇ ਮੈਂ ਉਹਨਾਂ ਦੇ ਖੁਦ ਪੇਜ਼ 'ਤੇ ਜੀਰੋ ਫੀਡਬੈਕ ਦਿੱਤੀ ਉਹਨਾਂ ਨੂੰ ਦਿਖਾਇਆ ਪੇਜ਼ 'ਤੇ ਲ਼ ਵੀਡਿਓ ਪਾਈ ਕਿ ਦੇਖੋ ਤੁਹਾਡਾ ਕਿੱਦਾਂ ਦਾ ਪ੍ਰੋਡਕਟ ਹੈ ਅਤੇ ਮੈਂ ਔਡਰ ਕੀ ਕੀਤਾ ਅਤੇ ਮਿਲਿਆ ਮੈਨੂੰ ਕੀ ਕਟੀ ਫਟੀ ਅਲੱਗ ਪ੍ਰਿੰਟ ਕਲਰ ਹੋਰ ਉਹਦੀ ਪੈਕਜਿੰਗ ਇੰਨੀ ਗੰਦੀ ਸੀ ਸਭ ਤੋਂ ਗੰਦਾ ਐਕਪੀਰੀਅਂਸ ਰਿਹਾ ਮੇਰਾ ਐਮਾਜੌਨ ਦੇ ਨਾਲ਼ ਬੈੱਡਸ਼ੀਟ ਮੰਗਵਾਉਣ ਦਾ ਮੈਂ ਅੱਗੇ ਵੀ ਬਹੁਤ ਸਾਰੇ ਪ੍ਰੋਡਕਟ ਮੰਗਵਾਉਂਦੀ ਹਾਂ ਪਰ ਇਹ ਵਾਲਾ ਪ੍ਰੋਡਕਟ ਕੁਝ ਜ਼ਿਆਦਾ ਹੀ ਉਹਨਾਂ ਨੇ ਮਤਲਬ ਗੰਦਾ ਜਿਹਾ ਭੇਜ ਦਿੱਤਾ ਉਹਦੀ ਮੈਨੂੰ ਨਹੀਂ ਚੰਗਾ ਲੱਗਿਆ ਜੀ